ਪੰਜਾਬੀ ਭਾਸ਼ਾ ਪੰਜਾਬੀਆਂ ਦੀ ਮਾਂ ਬੋਲੀ ਹੈ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਪੰਜਾਬ ਦਾ ਪੰਜਾਬੀ ਦੇ ਨਾਲ਼ ਬਹੁਤ ਪੰਜਾਬ ਦੇ ਲੋਕਾਂ ਦਾ ਪਿਆਰ ਰਿਹਾ ਹੈ ਜਦੋਂ ਤੋਂ ਆਜ਼ਾਦੀ ਮਿਲੀ ਹੈ ਤਾਂ ਵੀ ਪੰਜਾਬੀ ਪਾਕਿਸਤਾਨ ਦੇ ਟਾਈਮ ਤੋਂ ਹੀ ਚੱਲਦੀ ਆ ਰਹੀ ਪੰਜਾਬੀ ਇੱਥੇ ਆ ਕੇ ਬਹੁਤ ਵਧੀ ਫੁੱਲੀ ਹੈ ਲੋਕਾਂ ਦਾ ਪੰਜਾਬੀ ਨਾਲ਼ ਬਹੁਤ ਜ਼ਿਆਦਾ ਪਿਆਰ ਹੈ ਬਹੁਤ ਜ਼ਿਆਦਾ ਮੰਨਦੇ ਹਨ ਪੰਜਾਬੀ ਨੂੰ ਸਾਡੇ ਗੁਰੂਆਂ ਨੇ ਵੀ ਪੰਜਾਬੀ ਨੂੰ ਹੀ ਤਰਜੀਹ ਦਿੱਤੀ ਸਾਡਾ ਸਭ ਤੋਂ ਵੱਡਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਗੁਰਮੁਖੀ ਲਿਪੀ ਦੇ ਵਿੱਚ ਲਿਖਿਆ ਗਿਆ ਹੈ ਪੰਜਾਬੀ ਦੇ ਨਾਲ਼ ਸ ਹੁਣ ਤੱਕ ਤਾਂ ਬਹੁਤ ਜ਼ਿਆਦਾ ਪਿਆਰ ਸੀ ਪਰ ਹੁਣ ਆ ਕੇ ਅੱਜ ਕੱਲ੍ਹ ਦੀ ਪੀੜ੍ਹੀ ਨੇ ਪੰਜਾਬੀ ਨੂੰ ਥੋੜ੍ਹਾ ਜਿਹਾ ਸਾਈਡ 'ਤੇ ਕਰਨਾ ਸ਼ੁਰੂ ਕਰ ਦਿੱਤਾ ਹੈ ਕਾਰਨ ਇਹ ਹੈ ਕਿ ਉਹ ਅੰਗਰੇਜ਼ੀ ਨੂੰ ਜ਼ਿਆਦਾ ਆਪਣੇ ਅੰਦਰ ਸਮਾਈ ਜਾ ਰਹੇ ਨੇ ਕਿਉਂਕਿ ਅੰਗਰੇਜ਼ੀ ਭਾਸ਼ਾ ਦੇ ਨਾਲ਼ ਹੀ ਉਹਨਾਂ ਨੂੰ ਲੱਗਦਾ ਹੈ ਕਿ ਅੰਗਰੇਜ਼ੀ ਭਾਸ਼ਾ ਦੇ ਨਾਲ਼ ਹੀ ਅਸੀਂ ਆਪਣੇ ਭਵਿੱਖ ਨੂੰ ਵਧੀਆ ਬਣਾ ਸਕਦੇ ਹਾਂ ਸਾਰਿਆਂ ਦੀ ਜ਼ਿਆਦਾਤਰ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਦੀ ਇਹ ਖ਼ਵਾਹਿਸ਼ ਰਹੀ ਹੈ ਕਿ ਅਸੀਂ ਬਾਹਰ ਜਾਈਏ ਬਾਹਰ ਜਾ ਕੇ ਆਪਣੇ ਆਪ ਨੂੰ ਸੈੱਟ ਕਰੀਏ ਅਤੇ ਬਾਹਰ ਜਾਣ ਲਈ ਅੰਗਰੇਜ਼ੀ ਭਾਸ਼ਾ ਨੂੰ ਹੀ ਜ਼ਰੂਰੀ ਤਾਂ ਕਹਿ ਦਿੱਤਾ ਗਿਆ ਹੈ ਇਸ ਕਰਕੇ ਉਹਨਾਂ ਨੂੰ ਆਈਲੈਟਸ ਦੇਣਾ ਪੈਂਦਾ ਹੈ ਅਤੇ ਜਿਹੜੀ ਵੀ ਇੰਟਰਵਿਊ ਹੁੰਦੀ ਹੈ ਉਹ ਵੀ ਅੰਗਰੇਜ਼ੀ ਭਾਸ਼ਾ 'ਚ ਹੁੰਦੀ ਹੈ ਜਿਹਦੇ ਕਰਕੇ ਪੰਜਾਬੀ ਨੂੰ ਉਹ ਇੱਕ ਸਾਈਡ 'ਤੇ ਕਰਨਾ ਸ਼ੁਰੂ ਕਰ ਦਿੱਤਾ ਹੈ ਕੋਈ ਇੱਕ ਟਾਈਮ ਸੀ ਜਦੋਂ ਅਸੀਂ ਪੰਜਾਬੀ ਨੂੰ ਪੜ੍ਹ ਰਹੇ ਹੁੰਦੇ ਸੀ ਕੋਈ ਮੁਸ਼ਕਲ ਸ਼ਬਦ ਆਉਂਦਾ ਸੀ ਤਾਂ ਅਸੀਂ ਉਹਨੂੰ ਇੰਗਲਿਸ਼ ਦੇ ਵਿੱਚ ਦੇਖਦੇ ਸੀ ਕਿ ਕੀ ਇਹਦਾ ਮੀਨਿੰਗ ਕੀ ਬਣ ਸਕਦਾ ਹੈ ਪਰ ਅੱਜ ਕੱਲ੍ਹ ਤਾਂ ਇੰਗਲਿਸ਼ ਹੀ ਪੜ੍ਹ ਰਹੇ ਆ ਉਹਨੂੰ ਸਮਝਾਉਣ ਲਈ ਹੀ ਸਾਨੂੰ ਇੰਗਲਿਸ਼ ਦਾ ਹੀ ਵਰਡ ਲੱਭਣਾ ਪੈਂਦਾ ਕਿ ਉਹਦਾ ਮੀਨਿੰਗ ਆਸਾਨ 'ਚ ਕੀ ਹੋ ਸਕਦਾ ਹੈ ਇੰਨੀ ਕੁ ਪੰਜਾਬੀ ਨੂੰ ਉਹਨਾਂ ਨੇ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਹੈ ਪੰਜਾਬੀ ਪਰ ਇਹ ਹੈ ਕਿ ਆਪਣੀ ਮਾਂ ਬੋਲੀ ਨੂੰ ਛੱਡ ਕੇ ਕਿਸੇ ਦਾ ਵੀ ਭਵਿੱਖ ਜ਼ਿਆਦਾ ਨਹੀਂ ਬਣ ਸਕਦਾ ਆਪਣੀ ਮਾਂ ਬੋਲੀ ਨੂੰ ਹੀ ਹਰ ਵੇਲੇ ਆਪਣੇ ਨਾਲ਼ ਰੱਖਣਾ ਹੀ ਪੈਂਦਾ ਹੈ ਅਤੇ ਰੱਖਣਾ ਚਾਹੀਦਾ ਵੀ ਹੈ